ਜਿਵੇਂ ਕਿ ਸਾਨੂੰ ਸਕੂਲ ਟਾਈਮ ਤੋਂ ਹੀ ਬਚਪਨ ਦੇ ਵਿੱਚ ਹੀ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਟਿਕਨੋਲੋਜੀ ਦਾ ਟੈਕਨੋਲਜੀ ਦਾ ਕਿਹੜਾ ਵਿਸ਼ਾ ਜਾਣਦੇ ਹਾਂ ਜਾਂ ਇਸ ਨੂੰ ਕਿਵੇਂ ਜਾਣਾਂਗੇ ਜਾਂ ਕਿਵੇਂ ਜਾਣੀਏ ਜਾਂ ਅਸੀਂ ਕੀ ਕਰਾਂਗੇ ਪੜ੍ਹ ਲਿਖ ਕੇ ਕੀ ਬਣਾਂਗੇ ਜਿਵੇਂ ਕਿ ਇਹ ਸਾਨੂੰ ਨਹੀਂ ਪੜ੍ਹਾਇਆ ਗਿਆ ਇਸ ਕਰਕੇ ਅੱਜ ਅਸੀਂ ਕਾਫੀ ਪਰੇਸ਼ਾਨੀਆਂ ਦੇ ਵਿੱਚੋਂ ਦੀ ਲੰਘ ਰਹੇ ਹਾਂ ਸਾਨੂੰ ਕਈ ਥਾਵਾਂ ਦਾ ਕਈ ਐਸੇ ਵਿਸ਼ੇ ਹਨ ਲੀਰਿੰਗ ਦੇ ਕਈ ਐਸੇ ਵਿਸ਼ੇ ਹਨ ਜਿਹਨਾਂ ਦੇ ਵਿੱਚ ਬਾਹਰੋਂ ਸਾਨੂੰ ਪ੍ਰਾਈਵੇਟ ਕੋਰਸ ਕਰਨਾ ਪੈਂਦਾ ਹੈ ਜੋ ਕਿ ਇਸ ਨੂੰ ਸਕੂਲ ਟਾਈਮ ਤੋਂ ਹੀ ਕਰਨਾ ਚਾਹੀਦਾ ਸੀ ਇਸ ਨੂੰ ਹਰ ਇੱਕ ਨੂੰ ਇਹੀ ਇਹਦਾ ਵਿਸ਼ਾ ਬਣਨਾ ਪੜ੍ਹਨਾ ਚਾਹੀਦਾ ਹੈ